ਭਾਰਤੀ ਸਮਾਜ ਵਿੱਚ ਧਰਮ ਦੀ ਬਹੁਤ ਅਹਿਮ ਭੂਮਿਕਾ ਹੈ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਭਿੰਨਤਾਵਾਂ ਵਾਲ਼ਾ ਦੇਸ਼ ਹੈ ਅਤੇ ਇੱਥੇ ਬਹੁਤ ਸਾਰੇ ਧਰਮ ਪਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਧਰਮ ਹਨ ਹਿੰਦੂ ਮੁਸਲਿਮ ਸਿੱਖ ਇਸਾਈ ਜੋ ਹਿੰਦੂ ਧਰਮ ਦੇ ਪੰਡਿਤ ਪੁਜਾਰੀ ਹਨ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ ਅਤੇ ਕਈ ਤਰ੍ਹਾਂ ਦੇ ਰੀਤੀ ਰਿਵਾਜ਼ ਕਰਦੇ ਹਨ ਅਤੇ ਉਸ ਹੀ ਪ੍ਰਕਾਰ ਸਿੱਖਾਂ ਵਿੱਚ ਦਸਾਂ ਗੁਰੂਆਂ ਦੀ ਅਰਾਧਨਾ ਕੀਤੀ ਜਾਂਦੀ ਹੈ ਅਤੇ ਨਿਤਨੇਮ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਇਸ ਤਰ੍ਹਾਂ ਮੁਸਲਿਮ ਧਰਮ ਵਿੱਚ ਲੋਕ ਨਿਆਜ਼ ਕਰਦੇ ਹਨ ਅਤੇ ਰੋਜ਼ੇ ਰੱਖਦੇ ਹਨ ਈਸਾਈ ਵੀ ਵਿੱਚ ਜਾ ਕੇ ਪ੍ਰਾਰਥਨਾ ਕਰਦੇ ਹਨ ਪਰ ਗੱਲ ਤਾਂ ਇੱਕ ਹੀ ਹੈ ਕਿਉਂਕਿ ਸਾਰੇ ਪੀਰ ਪੈਗੰਬਰਾਂ ਨੇ ਇੱਕ ਹੀ ਗੱਲ ਕਹੀ ਹੈ ਕਿ ਅਨੇਕਤਾ ਵਿੱਚ ਏਕਤਾ ਹੈ ਅਤੇ ਕੋਈ ਵੀ ਧਰਮ ਅਲੱਗ ਨਹੀਂ ਹੈ ਸਿਰਫ਼ ਦੇਖਣ ਦਾ ਆਪਣਾ ਨਜ਼ਰੀਆ ਅਲੱਗ ਹੈ ਜਿਵੇਂ ਇੱਕ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਇਸ ਤਰ੍ਹਾਂ ਸਾਨੂੰ ਵੀ ਧਰਮਾਂ ਦੇ ਵਿੱਚ ਭੇਦ ਭਾਵ ਨਹੀਂ ਕਰਨਾ ਚਾਹੀਦਾ ਹੈ ਸਾਰੇ ਹੀ ਕੁਦਰਤ ਦੇ ਜੀਵ ਹਨ ਅਤੇ ਸਭ ਹੀ ਇੱਕ ਹੀ ਮਾਲਕ ਦੇ ਬੰਦੇ ਹਨ